ਬਾਈਕ ਦੇ ਚਾਰ ਗੇਅਰ ਹੁੰਦੇ ਹਨ ਅਤੇ ਇਸਦੀ ਬ੍ਰੇਕ ਵੀ ਹੁੰਦੀ ਹੈ ਜੋ ਕੀ ਪੈਰਾਂ ਵਿੱਚ ਹੁੰਦੀ ਹੈ ਤੇ ਇਸ 'ਤੇ ਹਮੇਸ਼ਾ ਆਪਣੀ ਕਿਤੇ ਵੀ ਆਪਾਂ ਯਾਤਰਾ ਤੇ ਜਾ ਰਹੇ ਆਂ ਤਾਂ ਆਪਾਂ ਨੂੰ ਧਿਆਨ ਧਿਆਨ ਰੱਖਣਾ ਚਾਹੀਦਾ ਕਿ ਬਾਈਕ 'ਤੇ ਜਾਂਦੇ ਵਕਤ ਉਸ ਵਿੱਚ ਦੇਖਣਾ ਚਾਹੀਦਾ ਹੈ ਕਿ ਉਸ ਵਿੱਚ ਟਾਇਰਾਂ ਵਿੱਚ ਹਵਾ ਹੈ ਜਾ ਨਹੀਂ ਹੈ ਦੂਸਰੇ ਨੰਬਰ 'ਤੇ ਉਸਦੀਆਂ ਬਰੇਕਾਂ ਚੈੱਕ ਕਰਨੀਆਂ ਚਾਹੀਦੀਆਂ ਹਨ ਇਸੇ ਤਰ੍ਹਾਂ ਹੀ ਉਸ ਵਿੱਚ ਪੈਟਰੋਲ ਵੀ ਚੈੱਕ ਕਰਨਾ ਚਾਹੀਦਾ ਕੀ ਪੈਟਰੋਲ ਹੈ ਕਿ ਨਹੀਂ ਹੈ ਕਿਉਂਕਿ ਰਸਤੇ ਵਿੱਚ ਕਦੇ ਆਪਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਅਸੀਂ ਇਸੇ ਤਰ੍ਹਾਂ ਹੀ ਮੈਂ ਸਾਈਕਲ ਵੀ ਚਲਾਇਆ ਹੋਇਆ ਹੈ ਤੇ ਪਹਿਲੀ ਵਾਰੀ ਜਦੋਂ ਮੈਂ ਸਾਈਕਲ ਛੋਟੇ ਹੁੰਦੇ ਚਲਾਇਆ ਸੀ ਤਾਂ ਮੈਨੂੰ ਬਹੁਤ ਮੁਸ਼ਕਿਲ ਲੱਗਿਆ ਸੀ ਤੇ ਪਰ ਉਸ ਸਾਈਕਲ ਚਲਾਣਾ ਇੱਕ ਮੁਸ਼ਕਿਲ ਲੱਗਿਆ ਸੀ ਕਿਉਂਕਿ ਇਸ ਵਿੱਚ ਇੱਕ ਪੁਰਾਣੇ ਸਮੇਂ ਵਿੱਚ ਜਿਆਦਾ ਲੋਕ ਸਾਈਕਲ ਹੀ ਚਲਾਉਂਦੇ ਸਨ ਪਰ ਅੱਜ ਕੱਲ ਜਿਆਦਾ ਸਾਈਕਲ ਦੀ ਵਰਤੋਂ ਘੱਟ ਗਈ ਹੈ ਅਤੇ ਇਸੇ ਤਰ੍ਹਾਂ ਸਾਈਕਲ ਮੈਨੂੰ ਉਨਾ ਜਿਆਦਾ ਉਹਦੇ ਤੇ ਜਲਦੀ ਆਪਾਂ ਨਹੀਂ ਪਹੁੰਚ ਸਕਦੇ ਜਦ ਕੀ ਕੋਈ ਬਾਈਕ ਵਗੈਰਾ ਹੋਵੇ ਤਾਂ ਆਪਾਂ ਜਲਦੀ ਆਸਾਨੀ ਨਾਲ ਦੂਜੇ ਸਥਾਨ ਤੇ ਪਹੁੰਚ ਸਕਦੇ ਹਾਂ